ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਸੁਰਿੰਦਰ ਸਿੰਘ ਗੱਲ ਕਰਦਾ ਪਿਆ ਵੀਰ ਜੀ ਮੈਂ ਇੱਕ ਮਤਲਬ ਘੁੰਮਣ ਲਈ ਜਾਣਾ ਚਾਹੁੰਦਾ ਸੀ ਮੇਰੀ ਫੈਮਲੀ ਦੇ ਨਾਲ ਅਸੀਂ ਸਿਕਸ ਮੈਂਬਰ ਹੈਗੇ ਐਂ ਅਤੇ ਮੈਂ ਇੱਥੋਂ ਦੀ ਉੱਤਰਾਖੰਡ ਘੁੰਮਣ ਲਈ ਜਾਣਾ ਚਾਹੁੰਦਾ ਹਾਂ ਅਤੇ ਮੈਨੂੰ ਜਸਟ ਇੰਨਫੋਰਮੈਸ਼ਨ ਚਾਹੀਦੀ ਸੀਗੀ ਤੁਹਾਡੇ ਥਰੂ ਕਿ ਅਗਰ ਇੱਥੋਂ ਦੀ ਜਲੰਧਰ ਤੋਂ ਜਾਂ ਕਪੂਰਥਲੇ ਤੋਂ ਲੈ ਲਉ ਤੁਸੀਂ ਕਪੂਰਥਲੇ ਤੋਂ ਲਓ ਕਪੂਰਥਲੇ ਤੋਂ ਉੱਤਰਾਖੰਡ ਦਾ ਕਿੰਨਾ ਡਿਸਟੇਂਸ ਹੋਏਗਾ ਅਤੇ ਕਿੰਨਾ ਤੇਲ ਦਾ ਖਰਚਾ ਆਊਗਾ ਜਾਂ ਕਿੰਨਾ ਟਰਾਂਸਪੋਰਟ ਦਾ ਅਤੇ ਕਿੰਨੇ ਚਾਰਜਸ ਲਉਗੇ ਸਾਡੇ ਤੋਂ ਕਿੰਨੇ ਪੈਸੇ ਲਓਗੇ ਅਤੇ ਉਹਦੇ ਵਿੱਚ ਤੇਲ ਐਡ ਹੁਣ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਉਹਦੀ ਟੋਟਲ ਅਮਾਊਂਟ ਦੱਸ ਦਿਓ ਅਤੇ ਉਹ 'ਚ ਕਿੰਨਾ ਟਾਇਮ ਲਗੇਗਾ ਸਾਨੂੰ ਪਹੁੰਚਣ 'ਤੇ ਉਹ ਵੀ ਮੈਨੂੰ ਦੱਸ ਦਓ ਅਤੇ ਉਹਦੇ ਵਿੱਚ ਸਾਨੂੰ ਹੋਰ ਕੋਈ ਫੈਸਟੀਲੀਜ ਹੈਗੀ ਤੁਹਾਡੇ ਵੱਲੋਂ ਕੋਈ ਕਨਸੈਸ਼ਨ ਮਿਲੇਗਾ ਜਾਂ ਕੁਛ ਮਿਲੇਗਾ ਮੈਨੂੰ ਉਹ ਵੀ ਦੱਸ ਦਿਓ